ਹਾਂਜੀ ਸਾਡਾ ਮੀਡੀਆ ਬਹੁਤ ਵਧੀਆ ਏ ਆ ਬਹੁਤ ਵਧੀਆ ਖਬਰਾਂ ਦਿੰਦਾ ਏ ਆ ਸਾਨੂੰ ਜਿਦਾਂ ਅਸੀਂ ਬ ਬੋਰ ਵਿੱਚ ਮੁੰਡਾ ਫਸਿਆ ਪਿਆ ਸੀਗਾ ਸਾਨੂੰ ਦਿਖਾਤਾ ਲਾਈਵ ਦਿਖਾਤਾ ਉਹਨੇ ਵੀ ਇੱਦਾਂ ਇੱਦਾਂ ਜਿਦਾਂ ਰੇਲ ਘਟਨਾ ਹੁੰਦੀ ਆ ਉਹ ਵੀ ਦੱਸ ਦਿੱਤਾ ਉਹਨੇ ਬਹੁਤ ਵਧੀਆ ਮੀਡੀਆ ਵਾ ਬਸ ਕੁਝ ਮੀਡੀਆ ਇੱਦਾਂ ਵਾ ਵੀ ਜਿਹੜੀ ਸੱਚੀ ਖਬਰ ਆ ਉਹ ਬਾਅਦ ਵਿੱਚ ਦਿੰਦੇ ਆ ਅਤੇ ਮਸਾਲੇ ਖਬਰਾਂ ਪਹਿਲਾਂ ਦੇ ਦਿੰਦੇ ਆ ਪਰ ਇੱਦਾਂ ਨਹੀਂ ਚਾਹੀਦਾ ਬਾਕੀ ਮੈਂ ਦੇਖੋ ਮੈਂ ਪੀ ਟੀ ਸੀ ਨਿਊਜ਼ ਏ ਬੀ ਸੀ ਨਿਊਜ਼ ਆਜ ਤੱਕ ਇੰਡੀਆ ਟੀ ਵੀ ਐੱਨ ਡੀ ਡੀ ਟੀ ਵੀ ਨਿਊਜ਼ ਇੰਡੀਆ ਟੂਜ਼ਡੇ ਮੈਂ ਰੋਜ਼ ਦੇਖਦੀ ਹਾਂ ਮੈਨੂੰ ਖਬਰਾਂ ਦਾ ਪਤਾ ਲੱਗਦਾ ਰਹਿੰਦਾ ਵਾ ਵੀ ਕਿੱਦਾਂ ਕਿੱਦਾਂ ਚਲਦਾ ਵਾ ਸਾਰਾ ਕੁਝ ਚਲਦਾ ਵਾ ਬਾਕੀ ਮੈਂ ਸਵੇਰੇ ਅ ਆਉਂਦੀਆਂ ਖਬਰਾਂ ਆਉਂਦੀਆਂ ਵਾਂ ਜੀ ਨਿਊਜ਼ ਅਜ਼ੀਤ ਅਖਬਾਰਾਂ ਆਉਂਦੀਆਂ ਵਾਂ ਮੈਂ ਪੜ੍ਹਦੀ ਹਾਂ ਮੈਂ ਸਵੇਰੇ ਚਾਹ ਪੀਂਦੀ ਹਾਂ ਪੜ੍ਹਦੀ ਹਾਂ ਮੈਨੂੰ ਪਤਾ ਲੱਗ ਜਾਂਦਾ ਵਾ ਵੀ ਕਿੱਦਾ ਸੋਨੇ ਦਾ ਕੀ ਰੇਟ ਆ ਚਾਂਦੀ ਦਾ ਕੀ ਰੇਟ ਆ ਪ੍ਰਧਾਨ ਮੰਤਰੀ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਬਹੁਤ ਖਬਰਾਂ ਬਹੁਤ ਪਤਾ